ਰੰਗੋਲੀ ਬਣਾਉਣਾ ਇੱਕ ਕਲਾ ਹੈ ਰੰਗੋਲੀ ਅਸੀਂ ਤਿਉਹਾਰਾਂ 'ਤੇ ਜਾਂ ਕਿਸੇ ਖਾਸ ਉਤਸਵ 'ਤੇ ਬਣਾਉਂਦੇ ਹਾਂ ਜਿੱਦਾਂ ਕਿ ਸਕੂਲ ਕਾਲਜਾਂ ਵਿੱਚ ਵੀ ਦਿਵਾਲੀ ਦੇ ਦਿਨਾਂ ਵਿੱਚ ਰੰਗੋਲੀ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਬੱਚੇ ਇਹਨਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਅਤੇ ਆਪਣੀ ਕਲਾ ਨੂੰ ਰੰਗੋਲੀ ਦੇ ਰੰਗਾਂ ਨਾਲ ਵੱਖਰੇ ਤਰੀਕੇ ਵਿੱਚ ਪੇਸ਼ ਕਰਦੇ ਨੇ ਦਿਵਾਲੀ ਦੇ ਤਿਉਹਾਰ 'ਤੇ ਸਾਰੇ ਲੋਕ ਆਪਣੇ ਘਰਾਂ ਵਿੱਚ ਵੀ ਰੰਗੋਲੀ ਬਣਾਉਂਦੇ ਨੇ ਕੁਝ ਰੰਗਾਂ ਦੇ ਫੁੱਲ ਬਣਾਉਂਦੇ ਅਤੇ ਕੁਝ ਲੋਕ ਰੰਗਾਂ ਨੂੰ ਦੀਵੇ ਦੇ ਵੀ ਆਕਾਰ ਦਿੰਦੇ ਨੇ ਸੂਰਜ ਨੂੰ ਪਾਣੀ ਚੜਾਉਣਾ ਵੀ ਇੱਕ ਲੋਕਾਂ ਦੀ ਮੰਨਤ ਹੈ ਕਈ ਲੋਕ ਸੂਰਜ ਨੂੰ ਦੇਵਤਾ ਮੰਨਦੇ ਨੇ ਅਤੇ ਉਹ ਸਵੇਰੇ ਇਸ਼ਨਾਨ ਕਰਕੇ ਸੂਰਜ ਨੂੰ ਪਾਣੀ ਦਿੰਦੇ ਨੇ ਇਹ ਸਮਝਦੇ ਨੇ ਕਿ ਅਸੀਂ ਸੂਰਜ ਦੇਵਤਾ ਜੀ ਨੂੰ ਪਾਣੀ ਦੇ ਰਹੇ ਹਾਂ ਇਹ ਪਾਣੀ ਉਹਨਾਂ ਤੱਕ ਪਹੁੰਚ ਰਿਹਾ ਹੈ ਅਤੇ ਇਹ ਸਭ ਕਰਕੇ ਉਹਨਾਂ ਦੇ ਸਾਰੇ ਕੰਮ ਸਫਲ ਹੋਣਗੇ ਇਹ ਸਭ ਵਿੱਚ ਉਹਨਾਂ ਦਾ ਵਿਸ਼ਵਾਸ ਹੁੰਦਾ ਹੈ ਕਈ ਲੋਕ ਧਾਗੇ ਵੀ ਬੰਨਦੇ ਨੇ ਹੱਥਾਂ 'ਤੇ ਪੈਰਾਂ 'ਤੇ ਜਾਂ ਗਲੇ 'ਚ ਪਾਉਂਦੇ ਨੇ ਕਈ ਇਸਨੂੰ ਨਜ਼ਰ ਦੇ ਬਚਾਅ ਲਈ ਬੰਨ ਬੰਨਦੇ ਨੇ ਜਿੱਦਾਂ ਕਿ ਨਜ਼ਰ ਲਈ ਕਾਲਾ ਧਾਗਾ ਅਸੀਂ ਆਮ ਤੌਰ 'ਤੇ ਕਈਆਂ ਦੇ ਬੰਨਿਆਂ ਦੇਖਿਆ ਹੈ ਬੱਚਿਆਂ ਦੇ ਵੀ ਬੰਨਿਆ ਜਾਂਦਾ ਹੈ ਤਾਂ ਕਿ ਬੱਚੇ ਨੂੰ ਨਜ਼ਰ ਨਾ ਲੱਗੇ ਅਤੇ ਬੱਚਾ ਤੰਦਰੁਸਤ ਰਹੇ ਮੱਥੇ 'ਤੇ ਸੰਧੂਰ ਤਾਂ ਸੁਹਾਗਣ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਇਸ ਤੋਂ ਵਗੈਰ ਸੁਹਾਗਣ ਦਾ ਸ਼ਿੰਗਾਰ ਅਧੂਰਾ ਜਾਪਦਾ ਹੈ ਮੱਥੇ 'ਤੇ ਲੱਗਿਆ ਸੰਧੂਰ ਹੀ ਔਰਤ ਦੀ ਸ਼ਾਨ ਵਧਾ ਦਿੰਦਾ ਹੈ ਅਤੇ ਇਸ ਤੋਂ ਔਰਤ ਦੇ ਵਿਆਹੇ ਹੋਣ ਦਾ ਵੀ ਪਤਾ ਲੱਗਦਾ ਹੈ ਹਰ ਇੱਕ ਬੰਦੇ ਦਾ ਰੱਬ ਨੂੰ ਮੰਨਣ ਅਤੇ ਪੂਜਣ ਦਾ ਆਪਣਾ ਵੱਖਰਾ ਅੰਦਾਜ਼ ਹੈ ਆਪਣਾ ਇੱਕ ਅਲੱਗ ਤਰੀਕਾ ਹੈ ਕਈ ਗੁਰਦੁਆਰੇ 'ਚ ਜਾਂਦੇ ਨੇ ਕਈ ਮੰਦਰਾਂ 'ਚ ਅਤੇ ਕਈ ਮਸਜਿਦਾ 'ਚ ਜਿੱਦਾਂ ਗੁਰੂ ਘਰ ਜਾਣ ਵਾਲੇ ਮੱਥਾ ਟੇਕਦੇ ਨੇ ਉਸੇ ਤਰ੍ਹਾਂ ਮੰਦਿਰ ਜਾਣ ਵਾਲੇ ਪੂਜਾ ਕਰਦੇ ਨੇ ਇੱਦਾਂ ਹੀ ਸਭ ਦਾ ਅਲੱਗ ਤਰੀਕਾ ਹੈ ਰੱਬ ਦੀ ਪੂਜਾ ਕਰਨ ਦਾ ਅਤੇ ਰੱਬ ਨੂੰ ਮੰਨਣ ਦਾ